ਅਸੀਂ ਜਾ ਸ਼ੁਰੂ ਤੋਂ ਹੀ ਪਿੰਡ ਤੋਂ ਬਿਲੋਂਗ ਕਰਦੇ ਹਾਂ ਅਤੇ ਪਿੰਡਾਂ ਦੇ ਵਿੱਚ ਜਿਹੜੀ ਆ ਸਾਡੀ ਮਾਂ ਬੋਲੀ ਪੰਜਾਬੀ ਤਕਰੀਬਨ ਬੋਲੀ ਜਾਂਦੀ ਆ ਅਤੇ ਸ਼ੁਰੂ ਤੋਂ ਹੀ ਜਿਹੜਾ ਸਾਡੀ ਪੜ੍ਹਾਈ ਵੀ ਆ ਉਹ ਵੀ ਪਿੰਡ ਦੇ ਸਕੂਲ ਤੋਂ ਹੀ ਸ਼ੁਰੂ ਹੋਈ ਅਤੇ ਮੀਡੀਅਮ ਵੀ ਸਾਰਾ ਪੰਜਾਬੀ ਦੇ ਵਿੱਚ ਸਬਜੈਕਟ ਸਾਰੇ ਜਿੰਨੇ ਵੀ ਆ ਪੰਜਾਬੀ ਦੇ ਵਿੱਚ ਹੀ ਸੀ ਸੋ ਜਿਹੜੀ ਪੰਜਾਬੀ ਬੋਲਣ ਦੀ ਗੱਲ ਹੈ ਜਿਹੜੀ ਉਹ ਸ਼ੁਰੂ ਤੋਂ ਸਾਡਾ ਜਿਹੜਾ ਸੱਭਿਆਚਾਰ ਆ ਜਾਂ ਪਿੰਡ ਦਾ ਰਹਿਣ ਸਹਿਣ ਸ਼ੁਰੂ ਤੋਂ ਆਪਾਂ ਸਾਰੇ ਪੰਜਾਬੀ ਬੋਲਦੇ ਹਾਂ ਤਕਰੀਬਨ ਸੋ ਬੋਲਣ ਦੇ ਵਿੱਚ ਤਾਂ ਕੋਈ ਵੀ ਸ਼ੁਰੂ ਤੋਂ ਪੰਜਾਬੀ ਬੋਲਦੇ ਆਉਂਦੇ ਆਪਾਂ ਅਤੇ ਬੋਲਣ ਦੇ ਵਿੱਚ ਕੋਈ ਵੀ ਮੁਸ਼ਕਲ ਨਹੀਂ ਜਿੱਥੋਂ ਤੱਕ ਲਿਖਣ ਦੀ ਗੱਲ ਆ ਅਤੇ ਲਿਖਣਾ ਵੀ ਕੰਮ ਜਿਹੜਾ ਸ਼ੁਰੂ ਤੋਂ ਸਕੂਲ ਜਿਹੜਾ ਪਿੰਡ ਦਾ ਆ ਉਹਦੇ ਵਿੱਚ ਆਪਾਂ ਤਕਰੀਬਨ ਪੰਜਾਬੀ ਦੇ ਵਿੱਚ ਸਾਰੇ ਸਬਜੈਕਟ ਪੜ੍ਹੇ ਆ ਤੋਂ ਸ਼ੁਰੂ ਤੋਂ ਲਿਖਣ ਦਾ ਕੰਮ ਵੀ ਜਿਹੜਾ ਪੰਜਾਬੀ ਦਾ ਸ਼ੁਰੂ ਕੀਤਾ ਹੋਇਆ ਉਦੋਂ ਜ ਜਦੋਂ ਇੰਨੀ ਕੁ ਜਿਹੜਾ ਵਾ ਹੋਲਡ ਬਣਿਆ ਪੰਜਾਬੀ ਦੇ ਉੱਤੇ ਵੀ ਲਿਖ ਵੀ ਐਂ ਵੀ ਬਿਲਕੁਲ ਸਹੀ ਲਈਦਾ ਆ ਜੇ ਕੋਈ ਪ੍ਰੋਬਲਮ ਆਈ ਨਹੀਂ ਜੇ ਜਿਹੜਾ ਕੁਸ਼ਚਨ ਆ ਵੀ ਪੰਜਾਬੀ ਦੇ ਵਿੱਚ ਬੋਲਣ ਜਾਂ ਲਿਖਣ ਵੇਲੇ ਕੋਈ ਮੁਸ਼ਕਲ ਆਈ ਆ ਇਹਦਾ ਮੈਂ ਇਹੀ ਆਨਸਰ ਦੇਣਾ ਚਾਹੂੰਗਾ ਵੀ ਨਹੀਂ ਪੰਜਾਬੀ ਬੋਲ ਵੀ ਵਧੀਆ ਲਈ ਦੀ ਆ ਕਿਉਂਕਿ ਸ਼ੁਰੂ ਤੋਂ ਮਾਹੌਲ ਇਹੋ ਜਿਹਾ ਆ ਪਿੰਡ ਦੇ ਵਿੱਚ ਹੀ ਰਹੇ ਹਾਂ ਸੋ ਲਿਖਦੇ ਵੀ ਰਹੇ ਹਾਂ ਦਸਵੀਂ ਤੱਕ ਜਿਹੜਾ ਵਾ ਪਿੰਡ ਦੇ ਵਿੱਚ ਹੀ ਪੜ੍ਹੇ ਹਾਂ ਸਾਰੇ ਸਬਜੈਕਟ ਪੰਜਾਬੀ ਦੇ ਵਿੱਚ ਹੀ ਸੀਗੇ ਉਹਦੇ ਵਿੱਚ ਪੜ੍ਹ ਪੜ੍ਹੀ ਦੀ ਵੀ ਸੀ ਪੰਜਾਬੀ ਲਿਖੀ ਲਿਖਣਾ ਵੀ ਪੈਂਦਾ ਸੀਗਾ ਸੋ ਲਿਖਣ ਦੇ ਵਿੱਚ ਵੀ ਜ਼ਿਆਦਾ ਮੁਸ਼ਕਲ ਕੋਈ ਆਈ ਨਹੀਂ ਸੋ ਬੋਲਣ ਦੇ ਵਿੱਚ ਵੀ ਨਹੀਂ ਆਈ ਅਤੇ ਲਿਖਣ ਦੇ ਵਿੱਚ ਵੀ ਨਹੀਂ ਤਕਰੀਬਨ ਵਧੀਆ ਹੋਲਡ ਹੀ ਆ ਪੰਜਾਬੀ ਦੇ ਉੱਤੇ